ਮੈਂ ਇਸ ਰਾਹੀਂ ਇਹ ਵਿਚਾਰ ਪੇਸ਼ ਕਰਨਾ ਚਾਹੁੰਦੀ ਹਾਂ ਕਿ ਜੋ ਵੀ ਕਾਰੋਬਾਰ ਸ਼ੁਰੂ ਹੁੰਦਾ ਹੈ ਉਸ ਨਾਲ ਛੋਟੇ ਛੋਟੇ ਹੋਰ ਕਾਰੋਬਾਰ ਸ਼ੁਰੂ ਕਰ ਲੈਣੇ ਚਾਹੀਦੇ ਹਨ ਕਿਉਂਕਿ ਜਿਸ ਨਾਲ ਉਸਨੂੰ ਜਿਸ ਨਾਲ ਉਸਦਾ ਕਾਰੋਬਾਰ ਸ਼ੁਰੂ ਹੋ ਸਕਦਾ ਹੈ ਅਤੇ ਜੋ ਉਸਨੂੰ ਨੁਕਸਾਨ ਹੋਇਆ ਹੁੰਦਾ ਹੈ ਉਸ ਵਿੱਚ ਉਹ ਆਪਣਾ ਉਸ ਵਿੱਚ ਆਪਣਾ ਘਾਟਾ ਪੂਰਾ ਕਰ ਸਕਦਾ ਹੈ ਅਤੇ ਆਪਣਾ ਕਾਰੋਬਾਰ ਹੋਰ ਵਧਾ ਸਕਦਾ ਹੈ ਇਸ ਲਈ ਆਪਣਾ ਕਾਰੋਬਾਰ ਚਲਾਉਣ ਲਈ ਉਸਨੂੰ ਹੋਰ ਛੋਟੇ ਛੋਟੇ ਕਾਰੋਬਾਰ ਸ਼ੁਰੂ ਕਰ ਲੈਣੇ ਚਾਹੀਦੇ ਹਨ ਜਿਸ ਨਾਲ ਉਸਦਾ ਕਾਰੋਬਾਰ ਵਧੀਆ ਚੱਲ ਸਕਦਾ ਹੈ ਅਤੇ ਸਾਰਾ ਪੈਸਾ ਵਧੀਆ ਇਨਵੈਸਟ ਹੋ ਸਕਦਾ ਹੈ ਇਸ ਘਾਟੇ ਨੂੰ ਪੂਰਾ ਕਰਨ ਲਈ ਛੋਟੇ ਛੋਟੇ ਕਾਰੋਬਾਰ ਸ਼ੁਰੂ ਕਰ ਲੈਣੇ ਚਾਹੀਦੇ ਹਨ